ਨੌ ਲੱਖ ਨੜਿਨਵੇਂ ਹਜ਼ਾਰ ਨੌ ਸੌ ਨੜਿਨਵੇਂ ਅੱਠ ਲੱਖ ਚੁਤਾਲ਼ੀ ਹਜ਼ਾਰ ਚਾਰ ਸੌ ਚੁਤਾਲ਼ੀ ਛੇ ਲੱਖ ਪੰਦਰਾਂ ਹਜ਼ਾਰ ਇੱਕ ਸੌ ਪੰਦਰਾਂ ਦੋ ਲੱਖ ਸਤਾਹਠ ਹਜ਼ਾਰ ਤਿੰਨ ਸੌ ਸਤਾਹਠ ਪੰਜ ਲੱਖ ਪਚਾਨਵੇਂ ਹਜ਼ਾਰ ਛੇ ਸੌ ਪਚਾਨਵੇਂ